ਮੇਰੀ ਜ਼ਿੰਦਗੀ ਵਿੱਚ ਵੀ ਇੱਕ ਅਜਿਹੀ ਕਿਤਾਬ ਹੈ ਜਿਹਦੇ ਬਾਰੇ ਮੈਂ ਪਹਿਲਾਂ ਕਦੇ ਸੋਚਿਆ ਨਹੀਂ ਸੀ ਕਿ ਇਹ ਮੇਰੇ ਪਸੰਦ ਦੀ ਕਿਤਾਬ ਹੈ ਅਤੇ ਇਸ ਕਰਕੇ ਮੈਂ ਉਹਨੂੰ ਜਦੋਂ ਖਰੀਦੀ ਸੀ ਕਿਤਾਬ ਉਦੋਂ ਹੀ ਕਿਤਾਬ ਖਰੀਦ ਕੇ ਮੈਂ ਆਪਣੀ ਅਲਮਾਰੀ ਵਿੱਚ ਰੱਖ ਕੇ ਛੱਡ ਦਿੱਤੀ ਸੀ ਕਿਉਂਕਿ ਓਦੋਂ ਟਾਇਟਲ ਹੀ ਇਸ ਤਰ੍ਹਾਂ ਦਾ ਸੀ ਕਿ ਦਾ ਫਾਇਲੋਸਫਿਕਲ ਕਨਸੈਪਸਨ ਔਫ ਸਵਦ ਅਤੇ ਜਦ ਦੂਸਰਾ ਟਾਇਟਲ ਸੀ ਕੇ ਸ਼ਬਦ ਫਲੋਸਿਫੀ ਅਤੇ ਕਿਉਂਕਿ ਮੈਂ ਤਾਂ ਸ਼ਬਦ ਸਮਝਦਾ ਸੀ ਅੱਖਰ ਜੋ ਹੁੰਦੇ ਨੇ ਲਿਖਣ ਵਾਲੇ ਓਹਨਾਂ ਦਾ ਅੱਖਰਾਂ ਦਾ ਸਮਝਦਾ ਸੀ ਅਤੇ ਫਲੋਸਫੀ ਦੇ ਵਿਸ਼ੇ ਨਾਲ ਮੇਰਾ ਵੈਸੇ ਨਾਲ ਤਾਲੁਕ ਹੈ ਨਹੀਂ ਸੀ ਪਹਿਲਾਂ ਤੋਂ ਤਾਂ ਕਰਕੇ ਛੱਡੀ ਜਦੋਂ ਇੱਕ ਵਾਰ ਮੇਰੇ ਦੋਸਤ ਮੈਨੂੰ ਮਿਲਿਆ ਤਾਂ ਓਹਨੇ ਮੈਨੂੰ ਬੁੱਕ ਪੜ੍ਹਨ ਬਾਰੇ ਸੁਜੈਸਟ ਕੀਤਾ ਤਾਂ ਓਹਦਾ ਕਹਿਣਾ ਮੰਨ ਕੇ ਮੈਂ ਕਿਤਾਬ ਪੜ੍ਹੀ ਅਤੇ ਇਹ ਕਿਤਾਬ ਪੜ੍ਹ ਕੇ ਮੈਨੂੰ ਕਿਤਾਬ ਬੜੀ ਇੰਟਰਸਟਿੰਗ ਲੱਗੀ ਕਿਉਂਕਿ ਓਹੀ ਇਸ ਸ਼ਬਦ ਦੀ ਗੱਲ ਨਹੀਂ ਕਰਦੀ ਸੀ ਜਿਹੜੀ ਅਸੀਂ ਬੋਲਦੇ ਹਾਂ ਜਾਂ ਲਿਖਦੇ ਹਾਂ ਓਹ ਤਾਂ ਜਿਹੜਾ ਅਣਦਿੱਸਦਾ ਸ਼ਬਦ ਹੈ ਜਿਹਦਾ ਕੋਈ ਆਕਾਰ ਨਹੀਂ ਹੈ ਜਿਹਦੇ ਬਾਰੇ ਗੁਰਬਾਣੀ ਲਿਖਦੀ ਹੈ ਕਿ ਸਬਜ ਸਬ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਓਸ ਸ਼ਬਦ ਦੀ ਗੱਲ ਕਰਦੀ ਹੈ ਫਲੋਸਫੀਕਲ ਵੇਅ ਦੇ ਵਿੱਚ ਅਤੇ ਜਦੋਂ ਓਹ ਕਿਤਾਬ ਮੈਂ ਪੜ੍ਹੀ ਤਾਂ ਮੈਨੂੰ ਬੜੀ ਇੰਟਰਸਟਿੰਗ ਲੱਗੀ ਅਤੇ ਉਸ ਨਾਲ ਕਿਤਾਬ ਨਾਲ ਮੇਰਾ ਬੜਾ ਪਿਆਰ ਬਣਿਆ ਉਸ ਤੋਂ ਬਾਅਦ ਅਤੇ ਓਹ ਕਿਤਾਬ ਨੂੰ ਪੜ੍ਹ ਕੇ ਅਤੇ ਮੈਂ ਆਪਣਾ ਮਨ ਬਦਲਿਆ ਓਸ ਤੋਂ ਬਾਅਦ ਮੈਂ ਬੁੱਕ ਨੂੰ ਓਹਦੇ ਕਵਰ ਤੋਂ ਦੇਖ ਕੇ ਜੱਜ ਕਰਨਾ ਛੱਡ ਦਿੱਤਾ ਅਤੇ ਹਰ ਕਿਤਾਬ ਜੋ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਨੇ ਸੁਜੈਸਟ ਕੀਤੀ ਜਾਂ ਪ੍ਰਾਪਤ ਕੀਤੀ ਵਧੀਆ ਕਿਤਾਬ ਮੈਂ ਓਹਨੂੰ ਪੜ੍ਹ ਕੇ ਓਸ ਤੋਂ ਬਾਅਦ ਹੀ ਓਸ ਵਾਰੇ ਆਪਣਾ ਵਿਊ ਬਣਾਉਣਾ ਸ਼ੁਰੂ ਕੀਤਾ ਉਸ ਨੂੰ ਪਸੰਦ ਕਰਨਾ ਸ਼ੁਰੂ ਕੀਤਾ